ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਗਿਆਨ ਸਾਗਰ ਹੋਸਪੀਟਲ ਤੋਂ ਬੋਲ ਰਹੇ ਓਂ ਡਾਕਟਰ ਸਾਹਿਬ ਅੱਛਾ ਜੀ ਮੈਨੂੰ ਕਿਸੇ ਨੇ ਨਾ ਤੁਹਾਡਾ ਨੰਬਰ ਦਿੱਤਾ ਸੀ ਕਿਸੇ ਜਾਣਕਾਰ ਨੇ ਵੀ ਤੁਹਾਡੇ ਹੋਸਪੀਟਲ 'ਚ ਨਾ ਸਾਰੀਆਂ ਸੁਵਿਧਾਵਾਂ ਬਹੁਤ ਚੰਗੇ ਤਰੀਕੇ ਨਾਲ ਮਿਲਦੀਆਂ ਨੇ ਕੀ ਇਹ ਗੱਲ ਸੱਚ ਹੈਗੀ ਦਰਅਸਲ ਇਹ ਐ ਨਾ ਕੀ ਮੈਂ ਆਪਦੇ ਨਾ ਪਰਿਵਾਰ ਲਈ ਨਾ ਇੱਕ ਵਧੀਆ ਸਿਹਤ ਸੰਭਾਲ ਘਰ ਲੱਭ ਰਿਆਂ ਤੇ ਉਨ੍ਹਾਂ ਦਾ ਨਾ ਬੀਮਾ ਵਗੈਰਾ ਵੀ ਕਰਵਾਇਆ ਹੈਨਾ ਜਿਹੜਾ ਮਹੀਨੇ ਦੇ ਮਹੀਨੇ ਸਾਨੂੰ ਪੈਸੇ ਦੇਣੇ ਪੈਂਦੇ ਨੇ ਤੇ ਤੁਸੀਂ ਦੱਸੋਂਗੇ ਵੀ ਤੁਹਾਡਾ ਕੀ ਹਿਸਾਬ ਕਿਤਾਬ ਐ ਤੁਸੀਂ ਬੀਮੇ ਵਗੈਰਾ ਦੇ ਕਰ ਦਿੰਨੇ ਓ ਕਾਗਜ਼ੀ ਕਾਰਵਾਈ ਕੇ ਨਈਂ ਅੱਛਾ ਤੇ ਹੋਰ ਕਿਹੜੀ ਸੁਵਿਧਾਵਾਂ ਨੇ ਜਿਵੇਂ ਜਿਵੇਂ ਕਿਸੇ ਨੇ ਐਮਰਜੈਂਸੀ ਹੈਨਾ ਦਾਖਲ ਹੋਣਾ ਹੋਵੈ ਤੇ ਕੀ ਕੀ ਮਤਲਬ ਕਰਨਾ ਪੈਂਦਾ ਪਹਿਲਾਂ ਅੱਛਾ ਠੀਕ ਐ ਜੀ ਤੇ ਬਾਕੀ ਮੈਂ ਸੁਣਿਆ ਵੀ ਟੈਸਟ ਵਗੈਰਾ ਇੱਥੇ ਘੱਟ ਰੇਟਾਂ ਤੇ ਹੋ ਜਾਂਦੇ ਸਰਕਾਰੀ ਰੇਟਾਂ ਤੇ ਗੱਲ ਸੱਚ ਐ ਹਾਂਜੀ ਠੀਕ ਐ ਤੇ ਸਾਡਾ ਇਹ ਨਾ ਵੀ ਅਸੀਂ ਨਾ ਪੂਰਾ ਹੈਨਾ ਮਹੀਨੇ ਤੋਂ ਮਹੀਨੇ ਬਾਅਦ ਨਾ ਅਸੀਂ ਆਪਦਾ ਨਾ ਜਿਹੜਾ ਹੈਗਾ ਸਿਹਤ ਦਾ ਚੈੱਕਅਪ ਕਰਾਉਂਦੇ ਆ ਵੀ ਸਾਨੂੰ ਕੋਈ ਬਿਮਾਰੀ ਵਗੈਰਾ ਤਾਂ ਨੀ ਜਾਂ ਕੋਈ ਸ਼ਰੀਰ ਚ ਸਾਡੇ ਕੁਝ ਹੋ ਤਾਂ ਰਿਹਾ ਤੇ ਤਾਂ ਕਰਕੇ ਅਸੀਂ ਟੈਸਟ ਵਗੈਰਾ ਵੀ ਕਰਵਾਨੇ ਆਂ ਤੇ ਐਕਸਰੇ ਵਗੈਰਾ ਬਾਰੇ ਦੱਸੋ ਅੱਛਾ ਵੀ ਇਹ ਤਾਂ ਨੀ ਹੁੰਦਾ ਵੀ ਰਿਪੋਟ ਗਲਤ ਵਗੈਰਾ ਆ ਜਾਂਦੀ ਹੋਵੇ ਤੇ ਸਾਨੂੰ ਦੁਆਰਾ ਪੈਸੇ ਲਾ ਕੇ ਕਿਤੇ ਹੋਰ ਕਰਵਾਣਾ ਪਵੇ ਠੀਕ ਐ ਡਾਕਟਰ ਸਾਹਿਬ ਤੇ ਤੁਸੀਂ ਗਰੰਟੀ ਲੈ ਰਹੇ ਓ ਵੀ ਪੂਰੀ ਹੈਨਾ ਰਿਪੋਟਾਂ ਵਗੈਰਾ ਤੁਹਾਡੇ ਸਹੀ ਆਉਂਦੀਆਂ ਨੇ ਹੈਨਾ ਠੀਕ ਐ ਤੇ ਜੇ ਕਿਸੇ ਬੰਦੇ ਨੇ ਐਡਮਿਟ ਹੋਣਾ ਹੋਵੇ ਹੈਨਾ ਜੇ ਕੋਈ ਇੱਕ ਬਿਮਾਰ ਹੋਵੇ ਤਾਂ ਉਸ ਦਾ ਇੱਕ ਦਿਨ ਦਾ ਖਰਚਾ ਕਿੰਨਾ ਕ ਪੈ ਜਾਂਦਾ ਜਿਵੇਂ ਅੱਛਾ ਸਰ ਤੇ ਤੁਹਾਡੇ ਉਹ ਆਯੂਸ਼ਮਾਨ ਕਾਰਡ ਜਿਹੜੇ ਅੱਜ ਕੱਲ੍ਹ ਸਰਕਾਰ ਨੇ ਚਲਾਏ ਹੋਏ ਨੇ ਤੁਹਾਡੇ ਇੱਥੇ ਲੈ ਲੈਂਦੇ ਨੇ ਅੱਛਾ ਤੇ ਬਾਅਦ ਚ ਇਹ ਤਾਂ ਨੀ ਹੋਵੇਗਾ ਵੀ ਸਾਨੂੰ ਹੈਨਾ ਉਹ ਕਹਿਣ ਕੀ ਇਹ ਕਾਰਡ ਨੀ ਚੱਲੂਗਾ ਸਾਡਾ ਇਲਾਜ ਵਗੈਰਾ ਅਸੀਂ ਨੀ ਕਰ ਸਕਦੇ ਪੀ ਬਾਅਦ ਚ ਇਹ ਨਾ ਨਾ ਹੋਵੇ ਵੀ ਸਾਨੂੰ ਮੁਸ਼ਕਿਲ ਹੋਵੇ ਕੀ ਸ ਅਸੀਂ ਬੀਮੇ ਵਾਸਤੇ ਹੈਨਾ ਐਨੇ ਪਾਸੇ ਟੱਕਰਾਂ ਖਾਂਦੇ ਫਿਰੀਏ ਠੀਕ ਐ ਸਰ ਤੇ ਔਨਲਾਈਨ ਰਜਿਸਟਰੇਸ਼ਨ ਬਾਰੇ ਦੱਸੋ ਕੁਛ ਮੈਂ ਸੁਣਿਆ ਕਈਆਂ ਤੋਂ ਕੀ ਤੁਸੀਂ ਔਨਲਾਈਨ ਵੀ ਕਹਿ ਦਿੰਦੇ ਓ ਕੀ ਰਜਿਸਟਰੇਸ਼ਨ ਕਰਦੋ ਤੇ ਉਹਦੇ ਨਾਲ ਵੀ ਹੁੰਦਾ ਵੀ ਬੰਦੇ ਦਾ ਟਾਈਮ ਬਚ ਜਾਂਦਾ ਹੁੰਦਾ ਐ ਠੀਕ ਐ ਜੀ ਤੇ ਜਿਵੇਂ ਕੀ ਕਹਿੰਦੇ ਆ ਬਾਕੀ ਹੈਨਾ ਟੈਸਟ ਵਗੈਰਾ ਬਾਰੇ ਹੀ ਪੁੱਛਣਾ ਸੀਗਾ ਵੀ ਕੋਈ ਖਾਸ ਵੀ ਹੁੰਦੇ ਜਿਵੇਂ ਪੂਰੇ ਬੋਡੀ ਦਾ ਅਸੀਂ ਚੈੱਕਅਪ ਕਰਾਨਾ ਹੋਵੇ ਤੇ ਇੱਕ ਇੱਕ ਟੈਸਟ ਨਾ ਕਰਕੇ ਅਸੀਂ ਪੂਰਾ ਪੈਕੇਜ ਹੀ ਲੈ ਲਈਏ ਫੇਰ ਉਹਦਾ ਕੀ ਹਿਸਾਬ ਕਿਤਾਬ ਐ ਪੂਰੇ ਅਸੀਂ ਬੋਡੀ ਦਾ ਚੈੱਕਅਪ ਕਿੰਨੇ ਸੌ ਰੁਪਏ ਚ ਕਰਾ ਸਕਦੇ ਆਂ ਅੱਛਾ ਫੇਰ ਇਹ ਤਾਂ ਬਹੁਤ ਈ ਵਧੀਆ ਗੱਲ ਐ ਹੈਨਾ ਵੀ ਸਾਨੂੰ ਇੱਕ ਜਗ੍ਹਾ ਈ ਸਾਰੀਆਂ ਸੁਵਿਧਾਵਾਂ ਮਿਲ ਜਾਣਗੀਆਂ ਹੈਨਾ ਚਲੋ ਇਹ ਤਾਂ ਵਧੀਆ ਈ ਹੈਗਾ ਨਾ ਫਿਰ ਜੇ ਸਰ ਕੋਈ ਗਰੀਬ ਪਰਿਵਾਰ ਤੋਂ ਹੋਵੇ ਹੈਨਾ ਜੇ ਉਹ ਮਤਲਬ ਆਸਫਲ ਹੋਵੇ ਸਾਰੇ ਪੈਸੇ ਦੇਣ ਚ ਤੁਸੀਂ ਵੀ ਉਹਨੂੰ ਕੋਈ ਰਿਆਇਤ ਵਗੈਰਾ ਦਿੰਨੇ ਓ ਕੇ ਨਈਂ ਹਾਂਜੀ ਅੱਛਾ ਚਲੋ ਇਹ ਤਾਂ ਬਹੁਤ ਈ ਵਧੀਆ ਗੱਲ ਹੈਗੀ ਹੈਨਾ ਵੀ ਕਿਸੇ ਗਰੀਬ ਦਾ ਵੀ ਇਲਾਜ ਹੋ ਜਵੇ ਬੇਚਾਰੇ ਉਹਨੂੰ ਵੀ ਜਿੰਦਗੀ ਮਿਲ ਜਵੇ ਤੇ ਬਾਕੀ ਸਰ ਮੈਂ ਤੁਹਾਡਾ ਫੋਮ ਵਗੈਰਾ ਰਜਿਸਟਰ ਕਰ ਦਵਾਂਗੀ ਹੈਨਾ ਫੋਮ ਔਨਲਾਈਨ ਈ ਭਰਿਆ ਜਾਵੇਗਾ ਨਾ ਸਾਰਾ ਉਂਜ ਤੇ ਮੈਂ ਭਰ ਦੇਮਾਂਗੀ ਤੇ ਮੈਂ ਆਉਣਾ ਸੀਗਾ ਕੱਲ੍ਹ ਪਰਸੋਂ ਆਪਦੇ ਪਰਿਵਾਰ ਨੂੰ ਲੇ ਕੇ ਚੈੱਕਅਪ ਕਾਰਵਾਣ ਵਾਸਤੇ ਠੀਕ ਐ ਹਾਂਜੀ ਠੀਕ ਐ ਜੀ ਤੇ ਆਜਮਾਂਗੇ ਤੇ ਬਾਕੀ ਜੇ ਮੈਨੂੰ ਹੋਰ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਮੈਂ ਤੁਹਾਨੂੰ ਦੁਬਾਰਾ ਕੋਲ ਕਰ ਸਕਦੀ ਐ ਠੀਕ ਐ ਜੀ ਧੰਨਵਾਦ ਜੀ ਸਰ ਬਹੁਤ ਚੰਗਾ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਤੁਸੀਂ ਦਿਲ ਦੇ ਸਾਰੇ ਉਹ ਪੁੱਛ ਲਏ ਜਿੰਨੇ ਵੀ ਸਵਾਲ ਸੀਗੇ ਠੀਕ ਐ ਸਰ ਧੰਨਵਾਦ ਜੀ ਧੰਨਵਾਦ